ਹਾਂਜੀ ਸਰ ਮੈਂ ਇਹ ਇੱਕ ਤ ਆਯੋਜਨ ਸੰਵ ਸੰਵੇਦਨ ਦੇ ਵਿੱਚ ਪੇਸ਼ਕਾਰੀ ਤਿਆਰ ਕਰ ਰਿਹਾ ਹਾਂ ਜਿਹਦੇ ਦੌਰਾਨ ਮੈਨੂੰ ਇੱਕ ਸਰਟੀਫਿਕੇਟ ਦੀ ਜ਼ਰੂਰਤ ਹੈ ਜਿਹਦੇ ਵਿੱਚ ਇੱਕ ਮੈਂ ਇੱਕ ਮੀਟਿੰਗ ਵਿੱਚ ਹਾਂ ਜਿਹਦੇ ਕਾਰਨ ਮੈਂ ਉਸ ਸਰਟੀਫਿਕੇਟ ਨੂੰ ਜਲਦ ਤੋਂ ਜਲਦ ਪ੍ਰਾਪਤ ਕਰਨਾ ਚਾਹੁੰਦਾ ਹਾਂ ਜਲਦ ਤੋਂ ਜਲਦ ਪ੍ਰਾਪਤ ਕਰਨਾ ਚਾਹੁੰਦਾ ਹਾਂ ਮੇਰੇ ਸਾਥੀ ਅੱਜ ਜੇ ਤੁਸੀਂ ਛੁੱਟੀ 'ਤੇ ਹੋ ਛੁੱਟੀ ਬਰੇਕ ਦੇ ਵਿੱਚ ਮੈਂ ਤੁਹਾਡੇ ਬਰੇਕ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜਿਹਦੇ ਨਾਲ ਡੀ ਜੀ ਲੋਕਰ ਦੇ ਨਾਲ ਤੁਸੀਂ ਆਹ ਸਾਰੇ ਸਰਟੀਫਿਕੇਟ ਜਿੰਨੇ ਵੀ ਹੈ ਉਹ ਉਸ ਤਰ੍ਹਾਂ ਉਹਨਾਂ ਨੂੰ ਉਹਨਾਂ ਨੂੰ ਇਸ ਥਾਂ 'ਤੇ ਪਹੁੰਚਾਇਆ ਜਾਵੇ ਸਹੀ ਤਰੀਕੇ ਅਤੇ ਸਪੱਸ਼ਟ ਰੂਪ ਦੇ ਵਿੱਚ ਪਹੁੰਚਾਇਆ ਜਾਵੇ ਉਹਨਾਂ ਨੂੰ ਉਹਨਾਂ ਦੇ ਦਸਤਾਵੇਜ਼ ਅਤੇ ਵਾਧੂ ਹੋਰ ਜੋ ਵੀ ਸਰਟੀਫਿਕੇਟ ਹਨ ਉਹਨਾਂ ਸਾਰਿਆਂ ਨੂੰ ਬਿਲਕੁਲ ਸੁਰੱਖਿਅਤ ਪੂਰਵ ਉਹਨਾਂ ਦੀ ਉਹਨਾਂ ਨੂੰ ਉਸ ਡੀ ਜੀ ਲੋਕਰ ਦੇ ਨਾਲ ਪਹੁੰਚਾਇਆ ਜਾਵੇ ਅਤੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਉਹਨਾਂ ਨੂੰ ਸੈਟਸਫੈਕਸ਼ਨ ਹੋ ਸਕੇ ਉਹਨਾਂ ਦੀ